ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਉੱਦਮਤਾ ਦਾ ਕਾਰੋਬਾਰ ਬਹੁਤ ਵੀ ਬ ਚੰਗਾ ਵਿਕਾਸ ਕੀਤਾ ਹੈ ਟੈਕਨੋਲਜੀ ਇੱਕ ਆਉਣ ਕਰਕੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਮਾਰਕੀਟਿੰਗ ਚੱਲ ਰਹੀ ਹੈ ਇਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਲੋਕ ਇੱਕ ਦੂਸਰੇ ਨਾਲ ਜੁੜ ਰਹੇ ਹਨ ਲੋਕਾਂ ਦੇ ਕਾਰੋਬਾਰ 'ਚ ਤਰੱਕੀ ਆ ਰਹੀ ਹੈ ਕਿਉਂਕਿ ਲੋਕ ਇੱਕ ਦੂਸਰੇ ਨਾਲ ਕੋਂਟੈਕਟ 'ਚ ਮੈਨੇਜ ਕਰ ਰਹੇ ਹਨ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਵੀ ਦਿੱਕਤ ਆਉਂਦੀ ਹੈ ਉਹ ਕਸਟਮਰ ਸਰਵਿਸ ਲੈਂਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਜਲਦੀ ਉਹਨਾਂ ਦਾ ਸਲਿਊਸ਼ਨ ਮਿਲ ਜਾਂਦਾ ਹੈਗਾ ਜੋ ਕਿ ਉਹਨਾਂ ਲਈ ਬਹੁਤ ਚੰਗਾ ਹੈ ਟੈਕਨੋਲੋਜੀ ਕਰਕੇ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਉੱਦਮਤਾ ਦਾ ਪ੍ਰ ਹੋਇਆ ਹੈ ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਉੱਦਮਤਾ ਕਾਰੋਬਾਰੀ ਵਿਕਾਸ ਨੂੰ ਬਹੁਤ ਵਧੀਆ ਬਣਾਇਆ ਹੈ ਮਾਰਕੀਟਿੰਗ ਬਹੁਤ ਜ਼ਿਆਦਾ ਵਧੀਆ ਹੋ ਚੁੱਕੀ ਹੈ ਇੰਪਰੂਵਡ ਇੰਪਰੂਵਡ ਹੋ ਚੁੱਕੀ ਹੈ ਕੋਸਟਮਰ ਸਰਵਿਸ ਹੀ ਬਹੁਤ ਵਧੀਆ ਕੀਤੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਆਈ ਸੀ ਉਸਨੇ ਇੱਕ ਵਾਰ ਹੀ ਉਸਨੂੰ ਕਾਲ ਕੀਤੀ ਅਤੇ ਉਸ ਉਹਨਾਂ ਨੇ ਦਸ ਮਿੰਟਾਂ ਵਿੱਚ ਉਹਦੀ ਸਾਰੀ ਇਨਫੋਰਮੇਸ਼ਨ ਕੱਢਤੀ ਅਤੇ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ